ਮੈਂ ਆਪਣੇ ਸਿਲਾਈ ਪ੍ਰੋਜੈਕਟਾਂ ਲਈ ਕਲਰਾਂ ਦੀ ਚੋਣ ਇਸ ਤਰ੍ਹਾਂ ਕਰਦੀ ਹਾਂ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸਮਾਂ ਹੋ ਗਿਆ ਆਪਣੇ ਅ ਕੱਪੜੇ ਸਿਉਂਦੀ ਨੂੰ ਤਾਂ ਕਰਕੇ ਮੈਨੂੰ ਪਹਿਲਾਂ ਹੀ ਦੇਖਦੇ ਸਾਰ ਹੀ ਹੈ ਨਾ ਪਤਾ ਲੱਗ ਜਾਂਦਾ ਵੀ ਇਹ ਵਾਲਾ ਕਲਰ ਇਹ ਵਾਲੇ ਕਲਰ ਦੇ ਨਾਲ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਅਤੇ ਮੇਰੇ ਦਿਮਾਗ ਵਿੱਚ ਪਹਿਲਾਂ ਹੀ ਇਹ ਚੀਜ਼ ਦੀ ਤਸਵੀਰ ਬਣ ਜਾਂਦੀ ਵੀ ਆਹ ਕਲਰ ਇਹ ਕਲਰ ਦੇ ਨਾਲ ਜਚੂਗਾ ਹੈ ਨਾ ਅਤੇ ਇੱਦਾਂ ਹੀ ਹੈ ਨਾ ਮੈਂ ਕਲਰ ਕੰਬੀਨੇਸ਼ਨ ਨੂੰ ਚੁਣਨ ਵਾਸਤੇ ਪਹਿਲਾਂ ਤਾਂ ਜਿਹੜੇ ਡਾ ਜ਼ਿਆਦਾ ਗੂੜ੍ਹੇ ਰੰਗ ਹੁੰਦੇ ਆ ਉਨ੍ਹਾਂ ਨੂੰ ਫਿੱਕੇ ਰੰਗਾਂ ਦੇ ਨਾਲ ਮੈਚ ਕਰ ਲੈਂਦੀ ਕਿਉਂਕਿ ਇਹ ਰੰਗ ਜ਼ਿਆਦਾ ਉੱਠਦੇ ਆ ਕਿਉਂਕਿ ਡਾਰਕ ਕਲਰ ਦੇ ਨਾਲ ਲਾਈਟ ਕਲਰ ਜ਼ਿਆਦਾ ਸੂਟ ਕਰਦੇ ਹੈ ਅਤੇ ਉਨ੍ਹਾਂ ਕਲਰਾਂ ਦੇ ਵਿੱਚੋਂ ਮੇਰੇ ਮਨਪਸੰਦ ਰੰਗ ਹੋ ਗਏ ਜਿੱਦਾਂ ਕਿ ਰੈੱਡ ਦੇ ਨਾਲ ਹੈ ਨਾ ਜਿਹੜਾ ਲਾਈਟ ਜਿਹਾ ਗ੍ਰੀਨ ਕਲਰ ਹੁੰਦਾ ਉਹ ਹੋ ਗਿਆ ਜਿੱਦਾਂ ਗੂੜ੍ਹੇ ਜਾਮਣੀ ਦੇ ਨਾਲ ਹੈ ਨਾ ਫਿੱਕਾ ਗੁਲਾਬੀ ਰੰਗ ਹੋ ਗਿਆ ਭੂਰੇ ਰੰਗ ਦੇ ਨਾਲ ਕ੍ਰੀਮ ਕਲਰ ਹੋ ਗਿਆ ਜਾਂ ਫਿਰ ਭੂਰੇ ਰੰਗ ਦੇ ਨਾਲ ਹੈ ਨਾ ਸੰਤਰੀ ਰੰਗ ਹੋ ਗਿਆ ਜਾਂ ਫਿਰ ਜਿੱਦਾਂ ਕਿ ਅ ਮਹਿਰੂਨ ਕਲਰ ਦੇ ਨਾਲ ਚਿੱਟਾ ਰੰਗ ਹੋ ਗਿਆ ਇੱਦਾਂ ਰੰਗ ਮੈਨੂੰ ਵਧੀਆ ਲੱਗਦੇ ਹੈ